ਮੇਰਾ ਖੇਤੀ ਦੇ ਵਿੱਚ ਮਨਪਸੰਦ ਦਾ ਪਹਿਲੂ ਵਾਹੁਣਾ ਅਤੇ ਬੀਜਣਾ ਹੈ ਜਦੋਂ ਵੀ ਮੈਂ ਖੇਤ ਜਾਂਦਾ ਹਾਂ ਤਾਂ ਮੈਂ ਅਕਸਰ ਫਸਲ ਜਦੋਂ ਫਸਲ ਦੀ ਵਢਾਈ ਹੁੰਦੀ ਹੈ ਜਾਂ ਕਟਾਈ ਹੁੰਦੀ ਉਸ ਤੋਂ ਬਾਅਦ ਜਦੋਂ ਫਸਲ ਨੂੰ ਵਾਹੁਣਾ ਹੁੰਦਾ ਹੈ ਜਾਂ ਅਗਲੀ ਫਸਲ ਨੂੰ ਬੀਜਣਾ ਹੁੰਦਾ ਤਾਂ ਮੈਂ ਖੇਤ ਜਾਂਦਾ ਹਾਂ ਅਤੇ ਟਰੈਕਟਰ ਨਾਲ ਪਿੱਛੇ ਹਲ ਜਾਂ ਹੋਰ ਕਈ ਸੰਦ ਨੇ ਜਿਹੜੇ ਕਿ ਵਾਹੁਣ ਬੀਜਣ ਲਈ ਵਰਤੇ ਜਾਂਦੇ ਹਨ ਜਿਵੇਂ ਕਿ ਤਵੀਆਂ ਰੋਟਾਵੇਟਰ ਉਨ੍ਹਾਂ ਨਾਲ ਪਹਿਲਾਂ ਖੇਤ ਦੀ ਵਹਾਈ ਕੀਤੀ ਜਾਂਦੀ ਹੈ ਅਤੇ ਪਹਿਲਾਂ ਖੇਤ ਨੂੰ ਵਾਹੁਣਾ ਅਤੇ ਖੇਤ ਨੂੰ ਵਾਹ ਕੇ ਉਹਨੂੰ ਬੀਜਣ ਯੋਗ ਬਣਾਉਣਾ ਅਤੇ ਜਦੋਂ ਖੇਤ ਦੀ ਚੰਗੀ ਤਰ੍ਹਾਂ ਵਹਾਈ ਕਰ ਦਿੱਤੀ ਜਾਂਦੀ ਆ ਤਾਂ ਬਾਅਦ 'ਚੋਂ ਉਹਦੇ ਵਿੱਚ ਸੀਡ ਡਰਿੱਲ ਨਾਲ ਕਈ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਜਿਵੇਂ ਕਿ ਅਸੀਂ ਕਣਕ ਝੋਨਾ ਅਤੇ ਨਰਮਾ ਵਰਗੀਆਂ ਫਸਲਾਂ ਬੀਜਦੇ ਹਾਂ ਅਤੇ ਜਦੋਂ ਵੀ ਮੈਂ ਖੇਤੀ ਕਰਦਾ ਹਾਂ ਤਾਂ ਮੇਰੇ ਡੈਡੀ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਘਰ ਵੀ ਜਦੋਂ ਮੈਂ ਟਰੈਕਟਰ ਲੈ ਕੇ ਜਾਂਦਾ ਹਾਂ ਤਾਂ ਮੇਰੀ ਮਾਤਾ ਉਹ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਜਦੋਂ ਮੈਨੂੰ ਟਰੈਕਟਰ ਚਲਾਉਂਦੇ ਜਾਂ ਵਾਹੀ ਕਰਦੇ ਨੂੰ ਦੇਖਦੇ ਹਨ ਤਾਂ ਉਹ ਹਮੇਸ਼ਾ ਹੀ ਖੁਸ਼ ਹੁੰਦੇ ਹਨ ਅਤੇ ਮੈਨੂੰ ਬਹੁਤ ਜ਼ਿਆਦਾ ਉਹ ਸਪੋਰਟ ਕਰਦੇ ਹਨ ਅਤੇ ਮੈਨੂੰ ਖੇਤੀ ਕਰਨ ਲਈ ਇੱਕ ਉਤਸ਼ਾਹਿਤ ਕਰਦੇ ਹਨ